ਮੈਂ ਕਿਹਾ ਭਾਜੀ ਆਹ ਟੂਟੀਆਂ ਆਲੇ ਪਲੰਬਰ ਬੋਲ ਰਹੇ ਜੀ ਮੈਂ ਕਿਹਾ ਭਾਜੀ ਯਾਰ ਉਹਨੇ ਮਾਨ ਨੇ ਨੰਬਰ ਦਿੱਤਾ ਸੀ ਤੁਹਾਡਾ ਮੈਂ ਕਿਹਾ ਭਾਜੀ ਯਾਰ ਸਾਡੇ ਘਰ ਦੀਆਂ ਨਾ ਟੂਟੀਆਂ ਖ਼ਰਾਬ ਹੋ ਗਈਆ ਵੀਆ ਜੀ ਹਾਂਜੀ ਤਾਂ ਉੱਪਰੋਂ ਨਾ ਪਾਣੀ ਨਹੀਂ ਆਉਂਦਾ ਪਿਆ ਅਸੀਂ ਭਾਂਡੇ ਧੋਣੇ ਤੋਂ ਬੈਠੇ ਅਤੇ ਸਵੇਰ ਦੇ ਹਾਂਜੀ ਮੈਂ ਕਿਹਾ ਹਾਂਜੀ ਇਹ ਟੂਟੀ ਚੋਂ ਪਾਣੀ ਨਹੀਂ ਆਉਂਦਾ ਪਿਆ ਬਸ ਉੱਪਰੋਂ ਸਪਲਾਈ ਹਾਂ ਮੇਨ ਸਪਲਾਈ ਨਹੀਂ ਹੈ ਉੱਪਰੋਂ ਸਿਰਫ਼ ਚਾਰ ਟੂਟੀਆਂ ਖ਼ਰਾਬ ਹੈ ਚਾਰ ਚਾਰ ਹਾਂਜੀ ਨਹੀਂ ਭਾਜੀ ਯਾਰ ਜੇ ਉਹੀ ਟੂਟੀਆਂ ਦਾ ਕੰਮ ਸਾਰ ਦਿੰਦੇ ਤਾਂ ਬਹੁਤ ਵਧੀਆ ਗੱਲ ਸੀਗੀ ਹਾਂਜੀ ਅੱਛਾ ਨਹੀਂ ਜੇ ਉਹਦੀ ਉਹ ਕਰਨੀ ਹੋਵੇ ਸਫਾਈ ਕਰਨੀ ਹੋਵੇ ਤਾਂ ਕਿਆ ਰੇਟ ਲਓਂਗੇ ਇੱਕ ਟੂਟੀ ਦਾ ਹਾਂਜੀ ਅੱਛਾ ਨਹੀਂ ਕਿੰਨੇ ਪੈਸੇ ਲਓਂਗੇ ਫਿਰ ਵੀ ਇੱਕ ਟੂਟੀ ਦੇ ਭਾਜੀ ਯਾਰ ਜੈਜ ਜੈਜ ਲਾ ਲਓ ਪਿੰਡ ਭਾਜੀ ਟਾਉਂਸਾਂ ਘਰ ਭਾਜੀ ਪੈਟਰੋਲ ਪੰਪ ਦੇ ਬੈਕ ਸੈਡ ਹਾਂਜੀ ਅੱਛਾ ਭਾਜੀ ਪੱਕਾ ਦੱਸਿਓ ਅੱਛਾ ਨਵੀਂ ਦਾ ਕਿਆ ਹਿਸਾਬ ਕਿਤਾਬ ਹੈ ਅੱਛਾ ਚੱਲ ਫਿਰ ਭਾਜੀ ਮੈਂ ਫ਼ੋਨ ਕਰਦਾ ਫਿਰ ਮੈਨੂੰ ਫ਼ੋਨ ਕਰ ਦਿਓ